ਮੈਂ ਆਪਣੇ ਘਰ ਦੇ ਵਿੱਚ ਪੌਦੇ ਉਗਾਉਣ ਲਈ ਦੋਮਟ ਮਿੱਟੀ ਦਾ ਪ੍ਰਯੋਗ ਦੀ ਵਰਤੋਂ ਕਰਦੀ ਹਾਂ ਪ੍ਰਯੋਗ ਕਰਦੀ ਹਾਂ ਜਿਹੜੀ ਕਿ ਪੌਦਿਆਂ ਵਾਸਤੇ ਬਹੁਤ ਅੱਛੀ ਹੁੰਦੀ ਹੈ ਪੌਦੇ ਔਰ ਮੈਂ ਪੌਦਿਆਂ ਦੇ ਵਿੱਚ ਕੋਈ ਬਾਹਰੋਂ ਖਾਦ ਲਿਆ ਕੇ ਉਸ ਦੀ ਵਰਤੋਂ ਨਹੀਂ ਕਰਦੀ ਮੈਂ ਘਰੇ ਹੀ ਖਾਦ ਬਣਾਉਂਦੀ ਹਾਂ ਜਿਵੇਂ ਕਿ ਉਹਦੇ ਵਿੱਚ ਮੈਂ ਪਿਆਜ ਦੇ ਛਿਲਕੇ ਪਾ ਦਿੰਦੀ ਹਾਂ ਕੇਲੇ ਦੇ ਛਿਲਕੇ ਹੋ ਗਏ ਔਰ ਜਿਹੜਾ ਖੋਪਾ ਹੁੰਦਾ ਆ ਉਹਦਾ ਜਿਹੜਾ ਬਰੂਦ ਹੁੰਦਾ ਆ ਉਹ ਸਭ ਮਿਲਾ ਕੇ ਗੋਹੇ ਦੀ ਖਾਦ ਵੀ ਪਾ ਦਿੰਦੀ ਹਾਂ ਬਸ ਇਹੀ ਜਿਹੜੀ ਇਹਨਾਂ ਸਾਰਿਆਂ ਦਾ ਮਿਸ਼ਰਣ ਬਣਾ ਕੇ ਮੈਂ ਆਪਣੇ ਪੌਦਿਆਂ ਦੇ ਵਿੱਚ ਇੱਕ ਤਰ੍ਹਾਂ ਦੀ ਖਾਦ ਬਣਾ ਕੇ ਪਾ ਦਿੰਦੀ ਹਾਂ